ਹੈਲੋ ਆਰਤੀ ਬੋਲ ਰਹੀ ਅੱ ਮੈਂ ਵਧੀਆ ਤੂੰ ਤੂੰ ਸੁਣਾ ਅੱਛਾ ਉਹ ਯਾਰ ਆਪਣੀ ਪਲਸ ਟੂ ਤਾਂ ਹੁਣ ਕੰਪਲੀਟ ਹੋ ਗਈ ਸੀਗੀ ਅੱਗੇ ਸੋਚਿਆ ਕੁਛ ਕਰਨ ਲਈ ਹਾਂ ਹਾਂ ਵੈਸੇ ਮੈਂ ਤਾਂ ਸੋਚਦੀ ਸੀਗੀ ਵੀ ਆਪਾਂ ਇੱਥੇ ਲੈਮਰੀਨ ਵਾਲ਼ੀ 'ਚ ਲੈ ਲਈਏ ਹਮ ਕੋਰਸਾਂ ਦਾ ਪਤਾ ਕੀਤਾ ਅੱਛਾ ਇੱਕ ਇੱਕ ਵਾਰੀ ਪਤਾ ਕਰ ਲੈਣਾ ਸੀਗਾ ਸੀ ਵੀ ਕਿੱਥੇ ਕਿੱਥੇ ਕੋਰਸ ਕਿੱਦਾਂ ਦੇ ਹੈਗੇ ਹੈ ਅਤੇ ਕਿੱਦਾਂ ਦੀ ਉੱਥੇ ਫੀਸ ਆ ਸਾਨੂੰ ਕੀ ਸਕੋਲਰਸ਼ਿਪ ਕਿਵੇਂ ਦੀ ਮਿਲਣੀ ਹੈ ਅਸੀਂ ਆਪਣਾ ਵੀ ਤਾਂ ਫ਼ਾਈਦਾ ਦੇ ਹਮ ਹਾਂ ਹਾਂ ਹਮ ਅੱਛਾ ਪਰ ਮੈਨੂੰ ਐਂ ਸੀ ਕਿ ਅਵ ਮੇਰੀ ਮੇਰੀ ਕੈਟੇਗਰੀ ਤਾਂ ਹੋਰ ਹੈ ਨਾ ਮੈਂ ਤਾਂ ਕਰਕੇ ਚੱਲ ਤੈਨੂੰ ਪੁੱਛਿਆ ਸੀਗਾ ਵੀ ਆਪਾਂ ਦੋਨੋ ਇੱਕ ਜਗ੍ਹਾ ਲੱਗ ਜੀਏ ਜਿੱਥੇ ਸਾਨੂੰ ਵਧੀਆ ਬੈਨੀਫਿਸ਼ਨ ਮਤਲਬ ਕਿ ਫੀਸ ਕੋਨਸੇਸ਼ਨ ਹੋ ਜੂਗੀ ਆਪਾਂ ਨੇ ਕਾਹਤੋਂ ਅਲੱਗ ਅਲੱਗ ਜਗ੍ਹਾ ਜਾਣਾ ਹੈ ਜਿੱਥੇ ਸਾਨੂੰ ਸਹੀ ਲੱਗਦਾ ਅਸੀਂ ਉੱਥੇ ਹੀ ਚੱਲਾਂਗੇ ਹਾਂ ਹੋਰ ਹੋਰ ਸੋ ਸੋਚਿਆ ਕੀ ਲੈਣਾ ਆ ਕੀ ਕਰਨਾ ਹੈ ਅੱਗੇ ਓਕੇ ਮੈਂ ਅੱਗੇ ਬੀ ਕੌਮ ਕਰਨ ਬਾਰੇ ਸੋਚਦੀ ਸੀਗੀ ਅੱਛਾ ਚਲ ਠੀਕ ਹੈ ਫੇਰ ਕੋਈ ਨਹੀਂ ਓਕੇ ਮੈਂ ਕਰਦੀ ਹਾਂ ਫੋਨ ਫੇਰ